ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਮੈਮ ਸਾਡਾ ਕਾਲਜ ਗੌਰਮੈਂਟ ਹੈਗਾ ਜੀ ਪੰਜਾਬ ਗੌਰਮੈਂਟ ਵੱਲੋਂ ਓਪ ਹੈਗਾ ਓਪਨ ਹੈਗਾ ਅਨੁਮਾਨਤਾ ਮਿਲੀ ਹੋਈ ਹੈ ਜੀ ਪੰਜਾਬ ਗੌਰਮੈਂਟ ਵੱਲੋਂ ਇਹ ਪੂਰੇ ਏਰੀਆ ਦਾ ਮਤਲਬ ਮੁਕਤਸਰ ਜ਼ਿਲ੍ਹੇ ਦੇ ਵਿੱਚ ਇੱਕ ਹੀ ਹੈ ਕਾਲਜ ਗੌਰਮੈਂਟਟ ਕਾਲਜ ਹਾਂਜੀ ਮੈਮ ਇੱਥੇ ਜਿਵੇਂ ਹੁਣ ਬੱਚਿਆਂ ਨੂੰ ਫਰੀ ਮਤਲਬ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈਗੀ ਆ ਐਸ ਸੀ ਬੱਚੇ ਜਿਹੜੇ ਹੈਗੇ ਸੀਗੇ ਉਹਨਾਂ ਨੂੰ ਸਕਾਲਰਸ਼ਿਪ ਦੇ ਬੇਸ 'ਤੇ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਹੈਗੀ ਆ ਉਹਨਾਂ ਦਾ ਮਤਲਬ ਇੱਕ ਫੀਸ ਉਹਨਾਂ ਦੀ ਇੱਕ ਰੁਪਇਆ ਵੀ ਨਹੀਂ ਲੱਗਦੀ ਹੈਗੀ ਹਾਂਜੀ ਮੈਮ ਮੈਂ ਐਕਚੁਅਲ 'ਚ ਮੈਂ ਕਾਲਜ 'ਚ ਠੀਕ ਹੈ ਅ ਕਲਰਕ ਹਾਂ ਜੀ ਮੈਂ ਇੱਥੇ ਕਲਰਕ ਹਾਂ ਜੀ ਮੈਂ ਐਡਮਿਸ਼ਨ ਨਹੀਂ ਲਈ ਜੀ ਇੱਥੇ ਹਾਂਜੀ ਹਾਂਜੀ ਮੈਮ ਉਹ ਹੀ ਤੁਹਾਨੂੰ ਹਾਂਜੀ ਮੈਮ ਹੋਸਟਲ ਦੀ ਫੈਸਿਲਿਟੀ ਹੈ ਜੀ ਮੈੱਸ ਦਾ ਮੈੱਸ ਦੀ ਫੈਸਿਲਿਟੀ ਹੈ ਜੀ ਆ ਬੱਚੇ ਆਉਂਦੇ ਹੈਗੇ ਜਿਹੜੇ ਦੂਰੋਂ ਹਨ ਜਿਹੜੇ ਅਪ ਡਾਊਨ ਕਰਦੇ ਹੈਗੇ ਉਹਨਾਂ ਨੂੰ ਪਾਸ ਬਣਾ ਕੇ ਦੇ ਦਿੱਤਾ ਜਾਂਦਾ ਬਕਾਇਦਾ ਕਾਲਜ ਵੱਲੋਂ ਜਿਹਨਾਂ ਨਾਲ ਕਿ ਉਹਨਾਂ ਦਾ ਕਿਰਾਇਆ ਲੱਗਦਾ ਹੀ ਨਹੀਂ ਹੈਗਾ ਹਾਂਜੀ ਹਾਂਜੀ ਮੈਮ ਹਾਂਜੀ ਕਲਚਰਲ ਐਕਟਿਵਿਟੀਜ਼ ਹਾਂਜੀ ਮੈਮ ਏਥਲੀਟ ਮੀਟ ਹੁੰਦੀ ਹੈਗੀ ਹੈ ਜੀ ਹਰ ਸਾਲ ਕਾਲਜ ਦੇ ਵਿੱਚ ਠੀਕ ਹੈ ਜੀ ਏਥਲੀਟ ਮੀਟ ਦੇ ਨਾਲ ਨਾਲ ਫਿਰ ਇਹ ਯੂਥ ਫੈਸਟੀਵਲ ਹੁੰਦੇ ਹੈਗੇ ਹੈ ਜੀ ਅਤੇ ਤੀਆਂ ਦੇ ਟਾਈਮ 'ਤੇ ਤੀਆਂ ਦਾ ਫੰਕਸ਼ਨ ਕਰਵਾਇਆ ਜਾਂਦਾ ਜੀ ਫੇਅਰਵੈਲ ਪਾਰਟੀ ਹੁੰਦੀ ਹੈਗੀ ਹੈ ਫ੍ਰੈਸ਼ਰ ਪਾਰਟੀਜ਼ ਹੁੰਦੀਆਂ ਹੈਗੀਆਂ ਬੱਚਿਆਂ ਨੂੰ ਮਤਲਬ ਫਿਜ਼ੀਕਲ ਗਰੋਥ ਵੀ ਉਹਨਾਂ ਤੋਂ ਗੇਮਜ਼ ਕਰਵਾਈਆਂ ਜਾਂਦੀਆਂ ਹੈਗੀਆਂ ਡੇਲੀ ਸਪੋਰਟਸ ਦਾ ਲੈਕਚਰ ਹੁੰਦਾ ਜੀ ਲਾਈਬਰੇਰੀ ਦਾ ਹੁੰਦਾ ਜੀ ਉਹਨਾਂ ਦੇ ਵਿੱਚ ਮਤਲਬ ਐਜੂਕੇਸ਼ਨ ਨੂੰ ਉਹਨਾਂ ਦਾ ਐਜੂਕੇਸ਼ਨ ਵਿੱਚ ਜਿਹੜੀ ਹੈਗੀ ਆ ਹੈ ਨਾ ਉਹਨੂੰ ਵਧਾਉਣ ਵਾਸਤੇ ਡੇਲੀ ਮਤਲਬ ਅ ਮਤਲਬ ਸਾਡੇ ਜਿਹੜੇ ਹੈਗੇ ਆ ਐਜੂਕੇਸ਼ਨ ਟੀਮ ਹੈਗੀ ਹੈ ਹੈ ਨਾ ਉਹ ਬਹੁਤ ਅੱਛੀ ਹੈਗੀ ਹੈ ਬੱਚਿਆਂ ਨੂੰ ਮਤਲਬ ਬਹੁਤ ਵਧੀਆ ਪੜ੍ਹਾਉਂਦੇ ਹੈਗੇ ਆ ਟੀਚਰ ਸਾਰੇ ਵਧੀਆ ਹੈਗੇ ਆ ਇੱਥੇ ਕਾਲਜ ਵੀ ਬਹੁਤ ਵਧੀਆ ਤੁਸੀਂ ਇੱਕ ਵਾਰੀ ਵਿਜਿਟ ਕਰੋ ਕਾਲਜ ਹਾਂਜੀ

ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਸਭ ਕੁਛ ਹੈ ਜੀ ਸਾਡੇ ਕੋਲ ਹਾਂਜੀ ਸੋ ਉਹਨਾਂ ਦੇ ਮਤਲਬ ਐਕਟੀਵਿਟੀਜ਼ ਨੂੰ ਹਾਂਜੀ ਮੈਮ ਸਰਟੀਫਿਕੇਟ ਵਗੈਰਾ ਵੀ ਦਿੱਤੇ ਜਾਂਦੇ ਹੈਗੇ ਐਕਟੀਵਿਟੀਜ਼ ਦੀਆਂ ਜੋ ਅਲੱਗ ਅਲੱਗ ਐਕਟੀ ਐਕਟੀਵਿਟੀਜ਼ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਹਾਂਜੀ ਲੈ ਕੇ ਜਾਂਦੇ ਹਾਂ ਜੀ ਹਾਂਜੀ ਹਾਂਜੀ ਮੈਮ ਕਰਦੇ ਹਾਂ ਜੀ ਥਰਡ ਪ੍ਰਾਈਜ ਸੇਕਿੰਡ ਪ੍ਰਾਈਜ ਕਈ ਵਾਰੀ ਫਸਟ ਫਸਟ ਵੀ ਹੁੰਦੇ ਹੈਗੇ ਆ ਹਾਂਜੀ ਬਾਕੀ ਤੁਸੀਂ ਆਓ ਜੀ ਇੱਕ ਵਾਰੀ ਫਿਰ ਹਾਂਜੀ ਫਿਰ ਕਰਦੇ ਹਾਂ ਅਸੀਂ ਹਾਂਜੀ ਹਾਂਜੀ ਹਾਂਜੀ ਓਕੇ ਮੈਮ ਥੈਂਕ ਯੂ ਜੀ ਹਾਂਜੀ